ਮਾਰਕੀਟਿੰਗ ਦੇ ਤਰੀਕੇ ਵੀ ਬਦਲ ਦਿੱਤੇ ਹਨ ਤਕਨੀਕ ਨੇ ਤਕਨੀਕ ਆ ਗਈ ਹੈ ਡਿ ਡਿਜੀਟਲ ਮਾਰਕੀਟਿੰਗ ਦੀ ਜ ਜਿਹੜੀ ਕਿ ਇਜੀਲੀ ਗਾਹਕ ਤੱਕ ਪਹੁੰਚਿਆ ਜਾ ਸਕਦਾ ਹੈ ਔਰ ਇਸ ਦੇ ਬਹੁਤ ਫ਼ਾਇਦੇ ਹਨ